ਬ੍ਰਹਿਮੰਡ ਬਾਰੇ ਕੁਝ ਚੀਜ਼ਾਂ ਅਜੇ ਵੀ ਅਨਸੁਲਝੀਆਂ ਹਨ ਸਾਇੰਸਦਾਨ ਅਜੋਕੇ ਸਮੇਂ ਵਿੱਚ ਇਹ ਹੀ ਜੋਰ ਲਗਾ ਰਹੇ ਕਿ ਕਿਸੇ ਹੋਰ ਗ੍ਰਹਿ 'ਤੇ ਖੋਜ ਕੀਤੀ ਜਾਵੇ ਤਾਂ ਕਿ ਜੀਵਨ ਬਾਰੇ ਪਤਾ ਲੱਗ ਸਕੇ ਪੁਲਾੜ ਚੰਦਰਯਾਨ ਭੇਜਿਆ ਗਿਆ ਪਰ ਉੱਥੇ ਜੀਵਨ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਅਸੀਂ ਕਿਤਾਬਾਂ ਵਿੱਚ ਕਈ ਕਹਾਣੀਆਂ ਪੜ੍ਹੀਆਂ ਕਿ ਮੰਗਲ ਗ੍ਰਹਿ 'ਤੇ ਜੀਵਨ ਹੈ ਚੰਦਰਮਾ 'ਤੇ ਪਾਣੀ ਹੈ ਆਦਿ ਕਈ ਵਾਰੀ ਅਸੀਂ ਅਨਪੜ੍ਹਤਾ ਕਹਾਣੀਆਂ ਵੀ ਪੜ੍ਹੀਆਂ ਹਨ ਕਿ ਫਲਾਣੇ ਗ੍ਰਹਿ 'ਤੇ ਆਦਮੀ ਰਹਿੰਦੇ ਹਨ ਆਦਿ ਪਰ ਇਸਦਾ ਹਜੇ ਕੋਈ ਸਬੂਤ ਨਹੀਂ ਮਿਲਦਾ ਹਜੇ ਤੱਕ ਸੋਰ ਮੰਡਲ ਵਿੱਚ ਸਿਰਫ਼ ਧਰਤੀ ਹੀ ਇੱਕ ਅਜਿਹਾ ਮਾਤਰ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ ਹਾਲਾਂਕਿ ਵਿਗਿਆਨੀਆਂ ਨੂੰ ਉਮੀਦ ਹੈ ਕਿ ਉਸ ਗ੍ਰਹਿ 'ਤੇ ਵੀ ਜੀਵਨ ਸੰਭਵ ਹੋ ਸਕਦਾ ਹੈ ਜਾਂ ਉਹਨਾਂ ਗ੍ਰਹਿ ਨੂੰ ਵੀ ਰਹਿਣ ਲਾਇਕ ਬਣਾਇਆ ਜਾ ਸਕਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਨਾਂ ਮੰਗਲ ਗ੍ਰਹਿ ਹੈ ਜੋ ਧਰਤੀ ਦੇ ਬਿਲਕੁਲ ਨੇੜੇ ਹੈ